ਹਾਂਜੀ ਨਮਸਕਾਰ ਹਾਂਜੀ ਹਾਂਜੀ ਅੱਛਾ ਕਿਉਂ ਅੱਛਾ ਅੱਛਾ ਅੱਛਾ ਜੀ ਅੱਛਾ ਜੀ ਅੱਛਾ ਹਾਂਜੀ ਠੀਕ ਐ ਹਾਂਜੀ ਹਾਂਜੀ ਇਹਦੇ ਦੋ ਕਲ ਪੈ ਗਏ ਸੀ ਜੀ ਜਾਂ ਤਾਂ ਤੁਸੀਂ ਉਦੋਂ ਹੀ ਮੇਰੇ ਕੋਲ ਆ ਜਾਂਦੇ ਉਹ ਮੇਰੇ ਆਫਿਸ ਵਿੱਚ ਆਪਾਂ ਉਹਨਾਂ ਨੂੰ ਬੁਲਾ ਲੈਂਦੇ ਚਲੋ ਜੇ ਉਸ ਵੇਲੇ ਨਹੀਂ ਕੋਈ ਬਣਿਆ ਤੁਹਾਡਾ ਮਨ ਜੇ ਤੁਸੀਂ ਸਵੇਰੇ ਤੇ ਇੱਕ ਵਾਰੀ ਆਓ ਬੈਂਕ ਆ ਜਾਓ ਆਪਾਂ ਮੂੰਹ ਸਾਹਮਣੇ ਗੱਲ ਕਰ ਲੈਦੇ ਆਂ ਵੀ ਤੂੰ ਉਹਨੇ ਕਿਹਾ ਜੇ ਤੋਂ ਮਾਫੀ ਮੰਗੇਗਾ ਬਲਕਿ ਮੰਨੇਗਾ ਤਾਂ ਠੀਕ ਹ ਨਹੀਂ ਤਾਂ ਆਪਾਂ ਉਹਦੀ ਸ਼ਿਕਾਇਤ ਕਰ ਦਿਆਂਗੇ ਤੁਸੀਂ ਇੱਕ ਵਾਰੀ ਸਵੇਰੇ ਆਓ ਤੇ ਹਾਂ ਨਹੀਂ ਜੀ ਨਹੀਂ ਸਾਨੂੰ ਉਥੋਂ ਦਿੱਕਤ ਆਉਂਦੀ ਹ ਨਾ ਸਾਡੀ ਹਾਇਰਸੋਕਿਓਰਟੀ ਜਿਹੜੀ ਉਹ ਸਾਡੇ ਕੰਨ ਖਿੱਚਦੇ ਨੇ ਅਗਲੇ ਕਹਿੰਦੇ ਨੇ ਤੁਹਾਡੇ ਹੁੰਦਿਆਂ ਇਹ ਸਾਰਾ ਕੁਝ ਹੁੰਦਾ ਪਿਆ ਨਾਲੇ ਔਰਤ ਜਾਤ ਨਾਲ ਕਿਸ ਬਤਮੀਜ਼ੀ ਕਰਨੀ ਹ ਕਿੱਥੋਂ ਦੀ ਸੱਭਿਅਤਾ ਐ ਉਹਨੂੰ ਨਹੀਂ ਸਮਝ ਆ ਗਈ ਤੇ ਹਾਂ ਹਾਂ ਹਾਂ ਬਿਲਕੁਲ ਨਹੀਂ ਆਪਾਂ ਨੂੰ ਇਸ ਤਰਾਂ ਚਾਹੀਦਾ ਹੀ ਨਹੀਂ ਉਹਨੂੰ ਵੀ ਨਹੀਂ ਚਾਹੀਦਾ ਤੁਸੀਂ ਇੱਕ ਵਾਰੀ ਆਓ ਉਥੇ ਸਵੇਰੇ ਆਓਗੇ ਆਪਾਂ ਨੂੰ ਪਤਾ ਲੱਗ ਜਾਏਗਾ ਉਹਨੂੰ ਬੁਲਾਵਾਂਗੇ ਉਹਨੂੰ ਵੀ ਸਮਝਾਵਾਂਗੇ ਵੀ ਇਹ ਤੇਰੀ ਬਦਮੀਜੀ ਤੋ ਇਹ ਸੀ ਤਾਂ ਹੋ ਸਕਦਾ ਕਈ ਬੰਦੇ ਆਗ ਸਨ ਮਾੜੇ ਹੁੰਦੇ ਨੇ ਉਹਨਾਂ ਨੂੰ ਜਦੋਂ ਤੱਕ ਸਿਵਕਾ ਨਾ ਦਿੱਤਾ ਜਾਏ ਨਾ ਸਮਝ ਨਹੀਂ ਆਉਂਦੀ ਕਿ ਇਹ ਨਾ ਹੋਵੇ ਵੀ ਤੁਸੀਂ ਚੁੱਪ ਕਰ ਜਾਓ ਅੱਗੇ ਵੀ ਤੁਸੀਂ ਚੁੱਪ ਕਰ ਗਏ ਉਦੋਂ ਹੀ ਕਹਿਣਾ ਚਾਹੀਦਾ ਸੀ ਹੁਣ ਤੁਸੀਂ ਹਾਂ ਚਲੋ ਕਈ ਵਾਰੀ ਹੁੰਦਾ ਬੰਦੇ ਦਾ ਮਨ ਹੀ ਹੋ ਜਾਦਾ ਕਈ ਵਾਰੀ ਬੇਮਨ ਬੈਠਾ ਹੁੰਦਾ ਬਾਕੀ ਹੁਣ ਹਾਂ ਹੁਣ ਨਹੀਂ ਲਿਹਾਜ਼ ਕਰਨ ਦੀ ਨਹੀਂ ਲੋੜ ਤੁਸੀਂ ਉੱਥੇ ਆਓ ਆ ਕੇ ਰਿਟਨ ਕੰਪਲੇਂਟ ਲੈ ਕੇ ਆਇਆ ਜੇ ਉਹਦੇ ਸਾਹਮਣੇ ਉਹਨੂੰ ਬੁਲਾਵਾਂਗੇ ਵੀ ਆ ਤਾਂ ਸੋਰੀ ਫੀਲ ਕਰੇਗਾ ਤੇ ਜਾਂ ਫਿਰ ਕੰਪਲੇਂਟ ਉੱਤੇ ਕਰਾਂਗੇ ਹਾਇਰਸਕਿਓਰਟੀ ਆਪੇ ਨੂੰ ਸਸਪੈਂਡ ਕਰੇਗੀ ਜਾ ਕੋਈ ਕਰੇਗੀ ਠੀਕ ਹ ਜੀ ਠੀਕ ਹੈ ਜੀ ਓਕੇ ਜੀ ਓਕੇ